ਭਾਰਤ ਦਾ ਪ੍ਰਚੀਨ ਅਤੇ ਮੱਧਕਾਲੀਨ ਇਤਿਹਾਸ ਬਹੁਤ ਪੁਰਾਣਾ ਹੈ ਜਿਸ ਵਿੱਚ ਬਹੁਤ ਸਾਰੇ ਰਾਜੇ ਆਉਂਦੇ ਹਨ ਜਿਵੇਂ ਮਹਿਮੂਦ ਗਜਨਵੀ ਅਕਬਰ ਜਹਾਂਗੀਰ ਨਾਦਰ ਸ਼ਾਹ ਐਵੇਂ ਦੇ ਬਹੁਤ ਸਾਰੇ ਰਾਜੇ ਨੇ ਜਿਹਨਾਂ ਨੇ ਆਪਣਾ ਰਾਜ ਚਲਾਇਆ ਪੰਜਾਬ ਦੇ ਉੱਪਰ ਆ ਕੇ ਅਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਪੰਜਾਬ ਦੇ ਜਿਹੜੇ ਰਾਜੇ ਹੋਏ ਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਦੱਸਣਾ ਚਾਹੁੰਦੀ ਜਿੰਨ੍ਹਾਂ ਤੋਂ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹਾਂ ਉਹਨਾਂ ਦਾ ਜਨਮ ਹੋਇਆ ਸੀ ਤੇਰ੍ਹਾਂ ਨਵੰਬਰ ਸਤਾਰ੍ਹਾਂ ਸੌ ਅੱਸੀ ਈਸਵੀ ਵਿੱਚ ਗੁਜਰਾਂਵਾਲਾ ਪਾਕਿਸਤਾਨ ਦੇ ਵਿੱਚ ਅਤੇ ਉਹਨਾਂ ਦੀ ਜਿਹੜੀ ਮੌਤ ਸੀਗੀ ਉਹ ਸਤਾਈ ਜੂਨ ਅਠਾਰ੍ਹਾਂ ਸੌ ਉਨਤਾਲ਼ੀ ਨੂੰ ਲਾਹੌਰ ਵਿੱਚ ਹੋਈ ਸੀ ਅਤੇ ਉਹਨਾਂ ਦੇ ਜਿਹੜੇ ਮਾਤਾ ਪਿਤਾ ਦਾ ਨਾਮ ਸੀਗਾ ਉਹ ਸੀਗਾ ਮ ਮਹਾਂ ਸਿੰਘ ਅਤੇ ਮਾਤਾ ਦਾ ਨਾਮ ਸੀਗਾ ਜਿੰਦ ਕੌਰ ਅਤੇ ਉਹਨਾਂ ਦੇ ਬਚਪਨ ਦਾ ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਦਾ ਨਾਮ ਬੁੱਧ ਸਿੰਘ ਸੀ ਅਤੇ ਉਹਨਾਂ ਦੇ ਕਾਫ਼ੀ ਵਿਆਹ ਹੋਏ ਨੇ ਅਤੇ ਜਿਵੇਂ ਜਿੰਦ ਕੌਰ ਗੁਲਬਾਹਰ ਬੇਗ਼ਮ ਗੁਲਾਬ ਕੌਰ ਅਤੇ ਆਦਿ ਅਤੇ ਉਸ ਤੋਂ ਬਾਅਦ ਉਹਨਾਂ ਦੇ ਬੱਚੇ ਹੈ ਦਲੀਪ ਸਿੰਘ ਹੋ ਗਏ ਜਿਵੇਂ ਖੜਕ ਸਿੰਘ ਸ਼ੇਰ ਸਿੰਘ ਰਤਨ ਸਿੰਘ ਈਸ਼ਰ ਸਿੰਘ ਆਦਿ ਕਾਫ਼ੀ ਬੱਚੇ ਸੀ ਉਹਨਾਂ ਦੇ ਅਤੇ ਉਸ ਤੋਂ ਬਾਅਦ ਉਹਨਾਂ ਨੇ ਲਾਹੌਰ ਲਾਹੌਰ ਅੰਮ੍ਰਿਤਸਰ ਆਦਿ ਨੂੰ ਜਿੱਤਿਆ ਸੀ ਪੰਜਾਬ ਦੇ ਉੱਪਰ ਆ ਕੇ ਅਤੇ ਉਹਨਾਂ ਦੀ ਜਦੋਂ ਮੌਤ ਹੋ ਜਾਂਦੀ ਸਤਾਈ ਜੂਨ ਅਠਾਰ੍ਹਾਂ ਸੌ ਉਨਤਾਲ਼ੀ ਈਸਵੀ ਨੂੰ ਤਾਂ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਬੇਟਾ ਏ ਦਲੀਪ ਸਿੰਘ ਅਤੇ ਉਹ ਪੰਜਾਬ ਦਾ ਪੰਜਾਬ ਦੇ ਉੱਪਰ ਰਾਜ ਕਰਦਾ ਏ ਅਤੇ ਉਸ ਤੋਂ ਬਾਅਦ ਦਲੀਪ ਸਿੰਘ ਤੋਂ ਬਾਅਦ ਪੰਜਾਬ ਪੰਜਾਬ ਦੇ ਵਿੱਚ ਸਿੱਖਾਂ ਦਾ ਰਾਜ ਹੈ ਜਿਹੜਾ ਉਹ ਖ਼ਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਜਿਹੜਾ ਦਲੀਪ ਸਿੰਘ ਹੁੰਦਾ ਉਹ ਅੰਗਰੇਜ਼ਾਂ ਦੇ ਨਾਲ਼ ਜਾ ਕੇ ਮਿਲ ਜਾਂਦਾ